ਭਾਰਤ ਵਿੱਚ ਬਹੁਤ ਸਾਰੇ ਮਨੁ ਮਸ਼ਹੂਰ ਨਾਚ ਹਨ ਜਿਵੇਂ ਕਿ ਭੰਗੜਾ ਗਿੱਧਾ ਲੁੱਡੀ ਮਲਵਈ ਗਿੱਧਾ ਪੰ ਸੰਮੀ ਡਾਂਡੀਆ ਕੱਥਕ ਕੁਚੀਪੁੜੀ ਮਣੀਪੁਰੀ ਉਡੀਸੀ ਇਹਨਾਂ ਵਿੱਚੋਂ ਜਿਹੜਾ ਮੈਨੂੰ ਸਾਰਿਆਂ ਨਾਲੋਂ ਵਧੀਆ ਲੱਗਦਾ ਉਹ ਹੈਗਾ ਭੰਗੜਾ ਭੰਗੜਾ ਪੱਟਾਂ ਦੇ ਜ਼ੋਰ ਨਾਲ ਪੈਂਦਾ ਪੂਰਾ ਲਲਕਾਰੇ ਮਾਰ ਕੇ ਪੈਂਦਾ ਹੈਗਾ ਹੈ ਮੇਰੇ ਦਾ ਮੇਰੇ ਜਿਹੜੇ ਕਾਲਜ ਦੇ ਦੋਸਤ ਸੀਗੇ ਉਹ ਸਾਰੇ ਭੰਗੜੇ ਦੇ ਸੀਗੇ ਅਤੇ ਉਹਦੇ ਕਰਕੇ ਮੈਨੂੰ ਭੰਗੜਾ ਵੀ ਕਾਫੀ ਪਸੰਦ ਹੈ ਮੈਨੂੰ ਭੰਗੜੇ 'ਚ ਸਾਰਿਆਂ ਨਾਲੋਂ ਵਧੀਆ ਭੰਗੜਚੀ ਪੰਮੀ ਬਾਈ ਲੱਗਦਾ ਹੈ ਉਹ ਗਾਉਣ ਦੇ ਨਾਲ ਨਾਲ ਭੰਗੜਾ ਵੀ ਪਾਉਂਦਾ ਹੈਗਾ ਹੈ